ਪੰਜਾਬੀ ਕੀ ਜੋ ਕਿ ਪੰਜਾਬ ਦੀ ਮਾਂ ਬੋਲੀ ਹੈ ਇਹ ਪਿ ਕੁਛ ਪਿਛਲੇ ਕੁਛ ਦਹਾਕਿਆਂ ਤੋਂ ਇਸ ਵਿੱਚ ਕਾਫੀ ਚੇਂਜ ਹੋਇਆ ਮਤਲਬ ਕਾਫੀ ਵਿਕਸਿਤ ਹੋਈ ਹੈ ਇਹ ਇਹ ਪਿੰਡਾਂ ਤੋਂ ਸ਼ਹਿਰਾਂ ਵਿੱਚ ਸ਼ਹਿਰਾਂ ਤੋਂ ਫਿਰ ਪੂਰੇ ਇੰਡੀਆ ਵਿੱਚ ਫਿਰ ਇੰਡੀਆ ਤੋਂ ਪੂਰੇ ਵਰਲਡ ਵਿੱਚ ਜਿੱਦਾਂ ਇਹ ਫੈਲ ਗਈ ਹੈ ਹੁਣ ਹੁਣ ਅਲੱਗ ਅਲੱਗ ਕੰਟਰੀਆਂ ਵਿੱਚ ਵੀ ਪੰਜਾਬੀ ਨੂੰ ਕਾਫੀ ਬੋਲਿਆ ਜਾਂਦਾ ਹੈ ਉੱਥੋਂ ਦੇ ਲੋਕ ਵੀ ਇਸ ਬੋਲੀ ਨੂੰ ਕਾਫੀ ਪਸੰਦ ਕਰਦੇ ਹਾਂ ਇਸ ਦਾ ਵਿਕਸਿਤ ਹੋਣ ਦਾ ਕਾਰਨ ਜਾਂ ਆਪਾਂ ਆਈ ਟੀ ਸੈਕਟਰ ਨੂੰ ਵੀ ਮੰਨ ਸਕਦੇ ਹਾਂ ਕਿਉਂਕਿ ਹੁਣ ਜਮਾ ਇੱਦਾਂ ਦਾ ਜ਼ਮਾਨਾ ਆ ਗਿਆ ਹੈ ਆਪਾਂ ਕਿਤੇ ਵੀ ਇਸ ਨੂੰ ਸੁਣ ਸਕਦੇ ਹਾਂ ਜਿੱਦਾਂ ਫੋਨ 'ਤੇ ਦੇਖ ਲਈਏ ਜਾਂ ਬਾਏ ਮੀਡੀਆ ਦੇਖ ਲਈਏ ਤਾਂ ਕਾਫੀ ਪੰਜਾਬੀ ਨੂੰ ਪਸੰਦ ਕੀਤਾ ਜਾ ਰਿਹਾ ਹੈ